ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ ਇੱਥੇ ਜਲ ਥਲ ਅਤੇ ਵਾਯੂ ਤਿੰਨਾਂ ਦੇ ਵਿੱਚ ਹੀ ਆਵਾਜਾਈ ਦੇ ਸਾਧਨ ਮੌਜੂਦ ਹਨ ਪਰ ਫਿਰ ਵੀ ਭਾਰਤੀ ਆਵਾਜਾਈ ਪ੍ਰਣਾਲੀ ਕਾਫ਼ੀ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਕਰ ਰਹੀ ਹੈ ਜ਼ਿਆਦਾਤਰ ਸਮੱਸਿਆਵਾਂ ਥਲ ਸੇ ਥਲ ਦੇ ਵਿੱਚ ਆ ਰਹੀਆਂ ਹਨ ਜਿਵੇਂ ਕਿ ਭੀੜੀਆਂ ਸੜਕਾਂ ਟ੍ਰੈਫਿਕ ਦੀ ਸਮੱਸਿਆ ਛੋਟੇ ਸ਼ਹਿਰਾਂ ਨੂੰ ਵੱਡੇ ਸ਼ਹਿਰਾਂ ਦੇ ਨਾਲ਼ ਲਿੰਕ ਨਹੀਂ ਕੀਤਾ ਹੋਇਆ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ਼ ਲਿੰਕ ਕਰਨ ਦੀ ਜ਼ਰੂਰਤ ਹੈ ਤਾਂ ਇਹੋ ਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਨਾਲ਼ ਭਾਰਤੀ ਜਿਹੜੀ ਪ੍ਰਣਾ ਆਵਾਜਾਈ ਦੀ ਪ੍ਰਣਾਲੀ ਹੈ ਉਹ ਜੂਝ ਰਹੀ ਹੈ